ਅੱਜ ਦੇ ਸੰਸਾਰ ਵਿੱਚ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਨੂੰ ਕੋਈ ਬਹੁਤੀਆਂ ਤਾਂ ਨਹੀਂ ਬਟ ਫਿਰ ਵੀ ਕੁਝ ਚੁਣੌਤੀਆਂ ਦਾ ਸਾਹਮਣਾ ਤਾਂ ਕਰਨਾ ਪੈ ਰਿਹਾ ਹੈ ਉਂਝ ਤਾਂ ਜੇ ਦੇਖਿਆ ਜਾਵੇ ਹਰੇਕ ਪਾਸੇ ਪੰਜਾਬੀ ਹੋਏ ਪਏ ਹੈ ਕੈਨੇਡਾ ਤਾਂ ਅੱਧਾ ਪੰਜਾਬ ਹੋਇਆ ਵਾ ਇਹ ਉੱਥੇ ਤਾਂ ਪੰਜਾਬੀ ਬੋਲਣਾ ਕੋਈ ਚੁਣੌਤੀ ਹੈ ਹੀ ਨਹੀਂ ਬਾਕੀ ਜਿਵੇਂ ਹੋਰ ਕੁਝ ਦੇਸ਼ ਹੈਗੇ ਨੇ ਸੰਸਾਰ ਦੇ ਜਿੱਥੇ ਜੇ ਪੰਜਾਬੀ ਬਹੁਤ ਘੱਟ ਗਿਣਤੀ 'ਚ ਹੈ ਸੋ ਉੱਥੇ ਉਨ੍ਹਾਂ ਨੂੰ ਬਾਕੀ ਭਾਸ਼ਾਵਾਂ ਸਿੱਖਣੀਆਂ ਪੈਂਦੀਆਂ ਨੇ ਅਤੇ ਕਈ ਵਾਰ ਪੰਜਾਬੀ ਹੁਣ ਜਿਵੇਂ ਆਪਣੇ ਭਾਰਤ ਦੇ ਵਿੱਚ ਹੈ ਪੰਜਾਬੀਆਂ ਨੇ ਆਪਣੇ ਮੇਨ ਪੰਜਾਬੀ ਆਉਂਦੀ ਹੁੰਦੀ ਹਿੰਦੀ ਜਾਂ ਅੰਗਰੇਜ਼ੀ ਬਟ ਜੇ ਹੁਣ ਦੇਖਿਆ ਜਾਵੇ ਜਿਵੇਂ ਜਰਮਨ ਹੈ ਇਟਾਲੀਅਨ ਹੈ ਇਹ ਭਾਸ਼ਾਵਾਂ ਬਾਰੇ ਨੌਲੇਜ਼ ਨਹੀਂ ਹੁੰਦੀ ਅਤੇ ਜੇ ਉਹ ਜਿਹੀਆਂ ਕੰਨਟਰੀਆਂ 'ਚ ਜਾਂਦੇ ਹਾਂ ਦੇਸ਼ਾਂ ਦੇ ਵਿੱਚ ਜਾਂਦੇ ਹਾਂ ਤਾਂ ਉੱਥੇ ਦੀਆਂ ਭਾਸ਼ਾਵਾ ਜੇ ਸਿੱਖਣੀਆਂ ਪੈਂਦੀਆਂ ਨੇ ਤਾਂ ਉਹਦੇ ਲਈ ਜੇ ਦੇਖਿਆ ਜਾਵੇ ਤਾਂ ਬਹੁਤੀਆਂ ਕਿਤਾਬਾਂ ਵੀ ਨਹੀਂ ਹੈ ਜੋ ਪੰਜਾਬੀ ਤੋਂ ਉਨ੍ਹਾਂ ਪੰਜਾਬੀਆਂ ਨੂੰ ਪੰਜਾਬੀ ਦੇ ਵਿੱਚ ਉਹ ਭਾਸ਼ਾਵਾਂ ਸਿਖਾ ਸਕੇ ਸੋ ਇੱਦਾਂ ਕਰਕੇ ਪੰਜਾਬੀਆਂ ਨੂੰ ਕਿਤੇ ਨਾ ਕਿਤੇ ਸਿੱਖਣ ਦੇ ਵਿੱਚ ਹੋਰ ਭਾਸ਼ਾਵਾਂ ਥੋੜ੍ਹੀ ਜਿਹੀ ਚੁਣੌਤੀ ਆਉਂਦੀ ਹੈ ਬਟ ਉੱਦਾਂ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਨੂੰ ਸਤਿਕਾਰ ਬਹੁਤ ਮਿਲਦਾ ਹੈ ਜੇ ਦੇਖਿਆ ਜਾਵੇ ਤਾਂ ਇੱਕ ਇਹ ਅਮੀਰ ਵਿਰਸੇ ਦੀ ਪਛਾਣ ਹੈ ਪੰਜਾਬੀ ਭਾਸ਼ਾ ਕਿਉਂਕਿ ਜੋ ਪੰਜਾਬੀ ਬੋਲੀ ਦੇ ਵਿੱਚ ਜਿਹੋ ਜਿਹੇ ਅੱਖਰ ਉਹ ਹੋਰ ਕਿਸੇ ਭਾਸ਼ਾ 'ਚ ਹੈ ਨਹੀਂ ਪੰਜਾਬੀ ਬੋਲਣ ਵਾਲਾ ਬੰਦਾ ਸਾਰੀਆਂ ਭਾਸ਼ਾਵਾਂ ਬੋਲ ਸਕਦਾ ਪਰ ਬਾਕੀ ਭਾਸ਼ਾਵਾਂ ਬੋਲਣ ਵਾਲੇ ਬੰਦਿਆਂ ਲਈ ਬਹੁਤ ਚੁਣੌਤੀ ਹੈ ਜੇ ਉਹਨਾਂ ਨੂੰ ਪੰਜਾਬੀ ਬੋਲਣੀ ਪਵੇ ਏਦਾਂ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਨੂੰ ਚੁਣੌਤੀਆਂ ਦਾ ਸਾਹਮਣਾ ਜੇ ਕਰਨਾ ਪੈਂਦਾ ਤਾਂ ਸਿਰਫ਼ ਸਿੱਖਣ ਸਮੇਂ ਹੈ ਉਹ ਵੀ ਥੋੜ੍ਹੀਆਂ ਬਹੁਤੀਆਂ ਉੱਦਾਂ ਕੋਈ ਨਹੀਂ ਹੈ ਜੇ ਦੇਖਿਆ ਜਾਵੇ ਜਿਵੇਂ ਪੰਜਾਬੀ ਦਾ ਅੱਖਰ ੜਾੜੇ ੜੂੜੇ ਨਹੀਂ ਹੈ ਇਹ ਤਾਂ ਹੋਰ ਕਿਸੇ ਭਾਸ਼ਾ 'ਚ ਹੈ ਹੀ ਨਹੀਂ ਬਾਕੀ ਭਾਸ਼ਾਵਾਂ ਦੇ ਅੱਖਰ ਐਨੇ ਕੁ ਸੌਖੇ ਹੈ ਵੀ ਪੰਜਾਬੀਆਂ ਨੂੰ ਬੋਲਣ 'ਚ ਕੋਈ ਚੱਕਰ ਹੀ ਹੈ ਨਹੀਂ ਬੜੀ ਅਸਾਨੀ ਨਾਲ਼ ਬੋਲੇ ਜਾ ਸਕਦੇ ਹੈ